ਪੰਜਾਬ ਵਿੱਚ ਮੁੱਖ ਸੱਭਿਆਚਾਰਕ ਰਜਤ ਅਤੇ ਸਮਾਜਿਕ ਨਿਯਮ ਜਿਹੜੇ ਨੇ ਉਹ ਮੇਨ ਇਹੀ ਨੇ ਇੱਕ ਤਾਂ ਪਰਾਈ ਔਰਤ ਅਤੇ ਪਰਾਏ ਮਰਦ ਦਾ ਜਿਹੜਾ ਸੰਗ ਹੈ ਉਹ ਸਮਾਜ ਜਿਹੜਾ ਹੈ ਉਸ ਨੂੰ ਇਜਾਜ਼ਤ ਨਹੀਂ ਦਿੰਦਾ ਅਤੇ ਦੂਸਰਾ ਹੈ ਜੋ ਕੁੜੀਆਂ ਦਾ ਜਿਹੜਾ ਭ ਬ ਭਰੂਣ ਹੱਤਿਆ ਦਾ ਜਿਹੜਾ ਹੈ ਇਹ ਵੀ ਬਹੁਤ ਜੋ ਸਮਾਜਿਕ ਕੁਰੀਤੀ ਚੱਲ ਰਹੀ ਹੈ ਇਸ 'ਤੇ ਵੀ ਇਹ ਵੀ ਬਰਖਿਲਾਫ ਹੈ ਸਮਾਜ ਦੇ ਵਿੱਚ ਅਤੇ ਜਿਹੜੀ ਹੈ ਲੜਕੀਆਂ ਅਤੇ ਲੜਕਿਆਂ ਦੀ ਜਿਹੜੀ ਬਰਾਬਰੀ ਦੀ ਹੈ ਜੋ ਹੱਕ ਨੇ ਉਹ ਵੀ ਇੱਕ ਹੈ ਸਮਾਜਿਕ ਕੁਰੀਤੀ ਬਾਕੀ ਦਹੇਜ ਪ੍ਰਥਾ ਹੈ ਜਿਹੜੀ ਉਹ ਵੀ ਇੱਕ ਸਮਾਜਿਕ ਕੁਰੀਤੀ ਹੈ ਜਿਹੜੀ ਚੱਲ ਰਹੀਆਂ ਹੈ